ਦੇਖੋ ਜੀ ਪਿੰਡਾਂ ਵਿੱਚ ਵਰਤੇ ਜਾਣ ਵਾਲੇ ਤਾਂ ਨੁਕਸੇ ਬਹੁਤ ਸਾਰੇ ਹੈ ਜੀ ਜੋ ਕਿ ਕਬਜ਼ ਤੇ ਛੁਟਕਾਰਾ ਪਾਉਂਦੇ ਨੇ ਜਿਵੇਂ ਕਿ ਸਾਡੇ ਪਿੰਡ ਵਿੱਚ ਜ਼ਿਆਦਾਤਰ ਤਾਂ ਲੋਕ ਦੇਸੀ ਨੁਕਸੇ ਵਰਤਣਾ ਹੀ ਪ੍ਰੈਫਰ ਕਰਦੇ ਨੇ ਜਿਵੇਂ ਕਿ ਜੀ ਪੁਰਾਣੇ ਬੁੜੇ ਤਾਂ ਅਜਵੈਣ ਲੈ ਕੇ ਆਪਣਾ ਅੰਦਰ ਸੈਟ ਕਰ ਲੈਂਦੇ ਤੇ ਅਤੇ ਸਭ ਤੇ ਜ਼ਿਆਦਾ ਵਰਤੇ ਜਾਣ ਵਾਲੀ ਚੀਜ਼ ਸੀ ਜੀ ਮਿੱਠਾ ਸੋਢਾ ਜੋ ਕਿ ਹਰ ਇੱਕ ਚੀਜ਼ 'ਚ ਵਰਤਿਆ ਜਾਂਦਾ ਤਾ ਜਿਵੇਂ ਕਿ ਜੀ ਗੁੜ ਬਣਾਉਂਦੇ ਤੇ ਉਹਦੇ 'ਚ ਵੀ ਵਰਤਿਆ ਜਾਂਦਾ ਤਾ ਜਦੋਂ ਕੋਈ ਬੰਦੇ ਨੂੰ ਕਬਜ਼ ਵਗੈਰਾ ਜਾਂ ਅਫਰੇਮੇ ਦਾ ਸਾਹਮਣਾ ਕਰਨਾ ਪੈਂਦਾ ਤਾ ਜੀ ਤਾਂ ਉਹ ਬੰਦਾ ਮਿੱਠੇ ਸੋਢੇ ਨੂੰ ਲੈ ਕੇ ਆਪਣੀ ਤਕਲੀਫ਼ ਨੂੰ ਘਟਾਉਣ ਦੀ ਕੋਸ਼ਿਸ਼ ਕਰਦਾ ਤਾ ਅਤੇ ਉਸ ਨਾਲ ਬਹੁਤ ਹੀ ਰਾਹਤ ਵੀ ਮਿਲਦੀ ਸੀ ਜੀ ਇਸ ਚੀਜ਼ ਤੇ ਅਤੇ ਇਹਦੇ ਕਰਕੇ ਜ਼ਿਆਦਾਤਰ ਲੋਕ ਡਾਕਟਰਾਂ ਕੋਲ ਜਾਣਾ ਪਸੰਦ ਨਹੀਂ ਤੇ ਕਰਦੇ ਜੋ ਕਿ ਆਪਣੇ ਘਰ ਦੀਆਂ ਬਣੀਆਂ ਚੀਜ਼ਾਂ ਹੋ ਗਈਆਂ ਜਿਵੇਂ ਕਿ ਅਜਵੈਣ ਹੋ ਗਈ ਕੋੜ ਤੁੰਬਿਆਂ ਦੀ ਫੱਕੀ ਹੋ ਗਈ ਲੋਕ ਜ਼ਿਆਦਾਤਰ ਇਹ ਚੀਜ਼ਾਂ ਨੂੰ ਪ੍ਰੈਫ਼ਰ ਕਰਦੇ ਤੇ ਅੱਗੇ ਪਿੰਡਾਂ 'ਚ ਐਂਵੇ ਹੀ ਹੁੰਦਾ ਤਾ ਵੈਦ ਕੋਲ ਜਾਂਦੇ ਤੇ ਲੋਕ ਅਤੇ ਬਹੁਤ ਹੀ ਘੱਟ ਵੱਧ ਜਾ ਕੇ ਖੁਸ਼ ਸੀ ਜੋ ਕਿ ਆਪਣੇ ਘਰ ਦੀਆਂ ਚੀਜ਼ਾਂ ਜਿਵੇਂ ਅਜਵੈਣ ਹੋ ਗਈ ਅਤੇ ਮਿੱਠਾ ਸੋਢਾ ਹੋ ਗਿਆ ਇਹ ਲੈ ਕੇ ਹੀ ਰ ਆਪਣੇ ਦਰਦ ਤੇ ਆਪਣੀ ਦਰਦ ਤੇ ਰਾਹਤ ਪਾਉਂਦੇ ਤੇ ਜਿਸ ਨਾਲ ਕਿ ਬਹੁਤ ਹੀ ਪ੍ਰਭਾਵਿਤ ਹੁੰਦਾ ਸੀ ਅਤੇ ਨਾ ਹੀ ਲੋਕ ਐਨਾਂ ਬਿਮਾਰੀ ਦਾ ਸਾਹਮਣਾ ਕਰਨਾ ਪੈਂਦਾ ਤਾ ਕਿਸੇ ਦਾ ਵੀ ਥੈਂਕ ਯੂ ਜੀ